ਪੰਜਾਬ ਵਿੱਚ ਸਰਕਾਰੀ ਸਕੀਮਾਂ ਬਹੁਤ ਸਾਰੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੀ ਭਲਾਈ ਦੇ ਲਈ ਸਭ ਤੋਂ ਪਹਿਲੇ ਤਾਂ ਲੇਡੀਜ ਨੂੰ ਆਪਣਾ ਆਧਾਰ ਕਾਰਡ ਦਿਖਾ ਕੇ ਉਹ ਕਿਤੇ ਵੀ ਕਿਸੇ ਵੀ ਸਰਕਾਰੀ ਰੋਡਵੇਜ਼ ਦੀ ਬੱਸ ਵਿੱਚ ਬੈਠ ਕੇ ਸਫ਼ਰ ਕਰ ਸਕਦੀਆਂ ਹਨ ਜਿਸ ਦਾ ਕੋਈ ਕਿਰਾਇਆ ਨਹੀਂ ਲੱਗੇਗਾ ਅਤੇ ਮੁਫ਼ਤ ਹੀ ਜਿਹੜਾ ਆਪਣਾ ਆਧਾਰ ਕਾਰਡ ਦਿਖਾ ਕੇ ਸਫ਼ਰ ਕਰ ਸਕਦੀਆਂ ਹਨ ਦੂਸਰਾ ਅਟੱਲ ਪੈਨਸ਼ਨ ਯੋਜਨਾ ਜਿਸ ਵਿੱਚ ਕਿ ਤੁਹਾਡਾ ਮਹੀਨੇ ਦਾ ਛੇ ਸੌ ਰੁਪਈਆ ਤੁਸੀਂ ਆਪਣੀ ਸ਼ੁਭ ਕਮਾਈ ਦੇ ਵਿੱਚੋਂ ਤੁਹਾਡਾ ਜਾਵੇਗਾ ਅਤੇ ਤੁਹਾਨੂੰ ਪੈਨਸ਼ਨ ਜਿਹੜੀ ਹੈ ਉਹ ਦਸ ਹਜ਼ਾਰ ਰੁਪਈਆ ਮਹੀਨਾ ਲੱਗ ਜਾਵੇਗੀ ਫਿਰ ਪੰਜਾਬ ਸਰਕਾਰ ਨੇ ਸਾਨੂੰ ਐੱਲ ਆਈ ਸੀ ਦੀ ਯਾਨੀ ਕਿ ਲਾ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਵੱਲੋਂ ਸਾਨੂੰ ਆ ਜੀਵਨ ਮੰਗ ਦੀ ਯੋਜਨਾ ਦਿੱਤੀ ਗਈ ਹੈ ਜਿਸ ਵਿੱਚ ਕਿ ਮਹੀਨੇ ਦਾ ਹਜ਼ਾਰ ਰੁਪਈਆ ਕੱਟਿਆ ਜਾਵੇਗਾ ਅਤੇ ਤੁਹਾਨੂੰ ਪੈਨਸ਼ਨ ਵਿੱਚ ਮਗਰੋਂ ਦਸ ਹਜ਼ਾਰ ਰੁਪਈਆ ਮਹੀਨਾ ਲੱਗ ਜਾਵੇਗਾ